ਸਤਿ ਸ਼੍ਰੀ ਅਕਾਲ ਮੈਮ ਕਿਵੇਂ ਹੋ ਮੈਮ ਵਧੀਆ ਮੈਮ ਮੈਂ ਐਕਚੁਅਲੀ ਛੋਟੀ ਜਿਹੀ ਮਦਦ ਚਾਹੀਦੀ ਸੀਗੀ ਮੈਮ ਮੇਰੀ ਫਰੈਂਡ ਹੈ ਉਹਨੇ ਤੁਹਾਡਾ ਨੰਬਰ ਦਿੱਤਾ ਸੀ ਕਿਉਂਕਿ ਇੱਧਰ ਮੈਂ ਨਵੀਂ ਆ ਨਾ ਇੱਧਰ ਮੈਨੂੰ ਮਠਿਆਈ ਵਗੈਰਾ ਦੀ ਜ਼ਰੂਰਤ ਸੀਗੀ ਕਾਫ਼ੀ ਸਾਡੇ ਇੱਧਰ ਕੋਈ ਫੰਕਸ਼ਨ ਹੈ ਤਾਂ ਉਹ ਕਹਿੰਦੀ ਸੀ ਕਿ ਤੁਹਾਡੇ ਤੋਂ ਪੁੱਛ ਲਏ ਕੋਈ ਤੁਸੀਂ ਸੁਜੈਸਟ ਕਰ ਸਕਦੇ ਹੋ ਨੇੜੇ ਤੇੜੇ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਮੈਮ ਓਕੇ ਮੈਮ ਕਿਆ ਕਿਆ ਵੈਸੇ ਹੋ ਜਾਂਦਾ ਹੈ ਇਹਦੇ ਵਿੱਚ ਮੇਨ ਉਹਨਾਂ ਦੀ ਸਪੈਸ਼ਲ ਆਈਟਮ ਕਿਆ ਹੁੰਦੀ ਆ ਹਾਂਜੀ ਹੋਰ ਹਾਂਜੀ ਹਾਂਜੀ ਹਾਂਜੀ ਔਰ ਪ੍ਰਾਈਜ਼ ਕਿਆ ਕਿਆ ਹੋ ਜਾਂਦਾ ਇਹਨਾਂ ਦਾ ਮਤਲਬ ਜੇ ਇਕੱਠੀਆਂ ਲਏ ਤਾਂ ਡਿਸਕਾਊਂਟ ਵਗੈਰਾ ਹੋਜੂਗਾ ਹਾਂਜੀ ਹਾਂਜੀ ਖੋਏ ਦੀ ਬਰਫ਼ੀ ਮੈਮ ਕਿੰਨੇ ਕਿਵੇਂ ਪ੍ਰਾਈਜ਼ ਹੈ ਓਕੇ ਅਤੇ ਕਾਜੂ ਕਤਲੀ ਮੈਮ ਓਕੇ ਮੈਮ ਵੈਸੇ ਨੇੜੇ ਕਿਹੜੀ ਹੈ ਜ਼ਿਆਦਾ ਓਕੇ ਮੈਮ ਇਹਦਾ ਐਡਰੈੱਸ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਮੈਮ ਥੈਂਕ ਯੂ